ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਵੇਲੇ ਫੀਸ ਦਾ ਜਿਹੜਾ ਢਾਂਚਾ ਉਹ ਵਿਸ਼ੇਸ਼ ਤੌਰ 'ਤੇ ਨਹੀਂ ਹੈ ਵੀ ਹਰ ਵਾਰੀ ਅਸੀਂ ਅੋਫਲਾਈਨ ਕਰਵਾਉਂਦੇ ਹਾਂ ਜਾਂ ਆਨਲਾਈਨ ਕਰਵਾਉਂਦੇ ਹਾਂ ਅਤੇ ਪਹਿਲਾਂ ਜਿਹੜਾ ਫੀਸ ਦਾ ਢਾਂਚਾ ਸੀ ਕੁਝ ਸਮਾਂ ਪਹਿਲਾਂ ਉਹ ਅੋਫਲਾਈਨ ਹੀ ਸੀ ਅਤੇ ਹੁਣ ਕੁਝ ਕੁ ਸਮੇਂ ਤੋਂ ਜਿਹੜਾ ਇਹ ਢਾਂਚਾ ਉਹ ਅੋਨ ਅੋਨਲਾਈਨ ਹੈ ਜਿਹੜਾ ਉਹ ਸ਼ੁਰੂ ਹੋਇਆ ਅਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਵੀ ਢਾਂਚਾ ਜਿਹੜਾ ਵੱਖਰਾ ਵੱਖਰਾ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਆ ਜਿਹੜੀ ਉਹ ਜਦੋਂ ਜਮ੍ਹਾਂ ਕਰਵਾਈ ਜਾਂਦੀ ਹੈ ਉਹ ਹੋਰ ਤਰੀਕੇ ਨਾਲ ਕਰਵਾਈ ਜਾਂਦੀ ਹੈ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਲੱਗ ਤਰੀਕੇ ਨਾਲ ਅਤੇ ਜ਼ਿਆਦਾਤਰ ਪਰ ਇਹ ਹੈ ਵੀ ਹੁਣ ਫੀਸ ਦੇ ਢਾਂਚੇ ਸੰਬੰਧੀ ਸਕੂਲਾਂ ਵਿੱਚ ਫੀਸ ਆ ਜਿਹੜੀ ਉਹ ਅੋਨਲਾਈਨ ਹੀ ਕੀਤੀ ਗਈ ਹੈ ਅਤੇ ਤਾਂ ਕਿ ਜਿਹੜੇ ਪੇਰੈਂਟਸ ਅਤੇ ਬੱਚੇ ਆ ਜਿਹੜੇ ਉਹ ਬੈਂਕਾਂ ਦੀ ਖੱਜਲ ਖੁਆਰੀ ਤੋਂ ਬਚ ਸਕਣ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਜਿਹੜਾ ਬਹੁਤ ਜ਼ਿਆਦਾ ਹਰ ਇੱਕ ਬੱਚੇ ਲਈ ਇਹ ਹੈ ਵੀ ਜਿਹੜੀ ਫੀਸ ਆ ਉਹਨੂੰ ਅੋਨਲਾਈਨ ਹੀ ਰੱਖਿਆ ਗਿਆ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਦਾ ਢਾਂਚਾ ਜਿਹੜਾ ਉਹ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੋਫਲਾਈਨ ਵੀ ਕੀਤਾ ਜਾਂਦਾ ਪਰ ਦਾਖਲਾ ਕਰਵਾਉਣ ਸੰਬੰਧੀ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਗੱਲ ਕਰੀਏ ਤਾਂ ਕੁਝ ਕੁ ਬੱਚਿਆਂ ਦੀ ਜਿਵੇਂ ਰਾਖਵੇਂ ਕੋਟੇ ਦੇ ਵਿੱਚ ਵੀ ਕੁਝ ਬੱਚੇ ਜਿਹੜੇ ਰੱਖੇ ਜਾਂਦੇ ਆ ਸਕੂਲਾਂ ਦੇ ਵਿੱਚ ਭਰਤੀ ਕੀਤੇ ਜਾਂਦੇ ਆ ਉਹਨਾਂ ਦੀ ਫੀਸ ਨਹੀਂ ਵੀ ਹੁੰਦੀ ਉਸ ਕਰਕੇ ਵੀ ਫਿਰ ਕੋਈ ਉਹਨਾਂ ਦਾ ਕੋਈ ਪ੍ਰੋਸੈਸ ਨਹੀਂ ਹੁੰਦਾ ਕੋਈ ਆਨਲਾਈਨ ਦਾ ਜਾਂ ਆਫਲਾਈਨ ਦਾ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸ ਦਾ ਜਿਹੜਾ ਢਾਂਚਾ ਜਮ੍ਹਾਂ ਕਰਵਾਉਣ ਦਾ ਉਹ ਵੱਖਰਾ ਵੱਖਰਾ ਹੈ ਧੰਨਵਾਦ ਜੀ